ਜੇ ਆਪਾਂ ਚਿੱਤਰਕਾਰੀ ਦੀ ਗੱਲ ਕਰੀਏ ਚਿੱਤਰਕਾਰੀ ਜਿਮੇ ਵੀ ਜਿਵੇਂ ਕਿ ਇੱਕ ਸਾਡਾ ਟੈਕਨੀਕਲ ਇੱਕ ਸਾਡੇ ਕੋਲ ਸੋਫਟਵੇਅਰ ਹੁੰਦਾ ਹੈ ਜਿਹਨੂੰ ਕਿ ਅਸੀਂ ਸੋਲਿਡਵਰਕਸ ਕਹਿੰਦੇ ਹਾਂ ਉਹਦੇ ਵਿੱਚ ਅਸੀਂ ਬੜੇ ਹੀ ਸੌਖੇ ਢੰਗ ਨਾਲ ਚਿੱਤਰਕਾਰੀ ਨੂੰ ਪੇਸ਼ ਕਰ ਸਕਦੇ ਹਾਂ ਉਹਦੇ ਵਿੱਚ ਸਾਡੇ ਕੋਲ ਕਈ ਤਰ੍ਹਾਂ ਦੀਆਂ ਕਮਾਂਡਾਂ ਅਵੇਲੇਬਲ ਹਨ ਅਤੇ ਅਸੀਂ ਉਸ ਕਮਾਂਡਾਂ ਦੀ ਮਦਦ ਨਾਲ ਅਸੀਂ ਉੱਥੇ ਵੱਖ ਵੱਖ ਤਰ੍ਹਾਂ ਦੇ ਚਿੱਤਰ ਅਸੀਂ ਵੱਖ ਵੱਖ ਤਰ੍ਹਾਂ ਦੀਆਂ ਡਾਇਗਰਾਮਾਂ ਉਹਦੇ ਉੱਪਰ ਡਰੋਅ ਕਰ ਸਕਦੇ ਹਾਂ ਅਤੇ ਉਹਨੂੰ ਅਸੀਂ ਕਿਹੜੇ ਵੀ ਐਂਗਲ ਤੋਂ ਕਿਸੇ ਵੀ ਐਂਗਲ ਤੋਂ ਉਸਨੂੰ ਘੁੰਮਾ ਘੁੰਮਾ ਕੇ ਵੀ ਅਸੀਂ ਦੇਖ ਸਕਦੇ ਹਾਂ ਅਤੇ ਉਸ ਵਿੱਚ ਸਾਨੂੰ ਬਹੁਤ ਜ਼ਿਆਦਾ ਮਦਦ ਮਿਲਦੀ ਹੈ ਚਿੱਤਰਕਾਰੀ ਬਣਾਉਣ ਦੇ ਵਿੱਚ ਅਤੇ ਚਿੱਤਰਕਾਰੀ ਨੂੰ ਦੇਖਣ ਦੇ ਵਿੱਚ ਇਹ ਅਸੀਂ ਔਨਲਾਈਨ ਸ ਵੀ ਅਸੀਂ ਸਿੱਖੀ ਹੈ ਅਤੇ ਕੁਝ ਅਸੀਂ ਯੂਟਿਊਬ 'ਤੇ ਇਹਦੇ ਟਿਊਟਸ ਪਏ ਹਨ ਉਥੋਂ ਅਸੀਂ ਸਿੱਖੀ ਹੈ ਅਤੇ ਇਹ ਬੜੀ ਹੀ ਵਧੀਆ ਗੱਲ ਹੈ ਕਿ ਅਸੀਂ ਔਨਲਾਈਨ ਵੀ ਸਿੱਖ ਸਕਦੇ ਹਾਂ ਸਾਨੂੰ ਕਿਸੇ ਓ ਟੀਚਰ ਦੀ ਵੀ ਇਹਦੇ ਵਿੱਚ ਲੋੜ ਨਹੀਂ ਹੈ ਅਤੇ ਅਸੀਂ ਔਨਲਾਈਨ ਵੀ ਇਹਨੂੰ ਸਿੱਖ ਕੇ ਅੱਗੇ ਆਪਣਾ ਤਰੱਕੀਆਂ ਪ੍ਰਾਪਤ ਕਰ ਸਕਦੇ ਹਾਂ ਅਤੇ ਜੇ ਇਸ ਤਕਨੀਕਾਂ ਨੂੰ ਅਪਣਾਇਆ ਜਾਵੇ ਤਾਂ ਬਹੁਤ ਸਾਰੇ ਜਿੰਨੇ ਵੀ ਚਿੱਤਰਕਾਰੀ ਵਿੱਚ ਰੁਚੀ ਰੱਖਦੇ ਹਨ ਇਹਨਾਂ ਨੂੰ ਤੁਸੀਂ ਅੱਗੇ ਅਪਣਾ ਸਕਦੇ ਹੋ ਅਤੇ ਇਹਨਾਂ ਦਾ ਵਧੀਆ ਤਰੀਕੇ ਨਾਲ ਇਹਨਾਂ ਦੀ ਵਰਤੋਂ ਵੀ ਕਰ ਸਕਦੀ ਹੋ ਅਤੇ ਅੱਗੇ ਕੰਪਟੀਸ਼ਨ ਵੀ ਇਹਦੇ 'ਚ ਲੜੇ ਜਾ ਸਕਦੇ ਹਨ ਅਤੇ ਨਵੀਂ ਚੀਜ਼ ਜਦੋਂ ਸੋਫਟਵੇਅਰ ਦੇ ਰਾਹੀਂ ਤੁਸੀਂ ਇਹਨਾਂ ਨੂੰ ਬਣਾਉਂਦੇ ਹੋ ਅਤੇ ਤਕਨੀਕਾਂ ਤੁਹਾਡੇ ਨਵੇਂ ਨਵੇਂ ਨੁਕਤੇ ਤੁਹਾਡੇ ਕੋਲ ਸਿੱਖਣ ਨੂੰ ਮਿਲਦੇ ਹਨ ਅਤੇ ਤੁਹਾਡੀ ਉਹ ਪਰਸਨੈਲਿਟੀ ਨੂੰ ਵੀ ਡਿਵੈਲਪ ਕਰਦੇ ਹਨ ਅਤੇ ਜਦੋਂ ਤੁਸੀਂ ਕਿਸੇ ਨੂੰ ਦੱਸਦੇ ਹੋ ਤਾਂ ਉਹ ਵੀ ਤੁਹਾਡੀ ਸ਼ਲਾਘਾ ਕਰਦਾ ਹੈ